ਨਮਸਕਾਰ ਸਰ ਹਾਂਜੀ ਸਰ ਕੱਲ ਤੁਸੀਂ ਆਏ ਸੀ ਨਾ ਆਪਣੇ ਉਹ ਇੱਕ ਸ਼ਾਵਰ ਜਾਂ ਖਰਾਬ ਸੀਗਾ ਦੇਖੋ ਭਾਈ ਉਹ ਟੂਟੀ ਸਹੀ ਕਰਨ ਨਾ ਚਲ ਆਏ ਸੀਗੇ ਹਾਂਜੀ ਹਾਂਜੀ ਉਧਰ ਹੀ ਆਏ ਸੀਗੇ ਹਾਂਜੀ ਹਾਂਜੀ ਤੇ ਉਹ ਤੁਸੀਂ ਉਦੋਂ ਉਸ ਤੇ ਹਾਂਜੀ ਤੁਸੀਂ ਉਸ ਟਾਈਮ ਜਦੋਂ ਆਪਣੀ ਗੱਲ ਹੋਈ ਸੀ ਤੁਸੀਂ ਕਿਹਾ ਸੀਗਾ ਆਪਾਂ ਸੋ ਰੁਪਏ ਉਹਦਾ ਕਿਹਾ ਸੀਗਾ ਪਾਈਪ ਦਾ ਤੇ ਤੇ ਟੂਟੀ ਦਾ ਡੇਡ ਸੋ ਕਿਹਾ ਸੀਗਾ ਉਸ ਤੋਂ ਬਾਅਦ ਮਮਾ ਨਾਲ ਗੱਲ ਹੋਈ ਤੇ ਜਦੋਂ ਤੁਸੀਂ ਸਹੀ ਕਰ ਗਏ ਤੇ ਤੁਸੀਂ ਮੈਨੂੰ ਉਹਨਾਂ ਗੂਗਲ ਪੇ ਦਾ ਦੋ ਸੋ ਰੁਪਏ ਕਹਿ ਰਹੇ ਹੋ ਕਿ ਚੱਕਰ ਫਿਰ ਫਿਰ ਹਾਂਜੀ ਹਾਂਜੀ ਘਰੇ ਤਾਂ ਨਹੀਂ ਸੀਗਾ ਤਾਂ ਹੀ ਮੈਂ ਹਾਂਜੀ ਹਾਂਜੀ ਹਾਂਜੀ ਤਾਂ ਹੀ ਮੈਂ ਕਹਿ ਰਿਹਾ ਨਾ ਪ੍ਰਾਈਜ ਨੈਗੋਸੇਟ ਤਾਂ ਕਰ ਲੈਣਾ ਤੁਸੀਂ ਡੇਡ ਸੋ ਕਿਹ ਕੇ ਹੁਣ ਤੁਸੀਂ ਦੋ ਸੋ ਮੰਗ ਰਹੇ ਹੋ ਜੀ ਅੱਛਾ ਜੀ ਅੱਛਾ ਠੀਕ ਹੈ ਜੀ ਨਹੀਂ ਮੈਂ ਤਾਂ ਤੁਹਾਨੂੰ ਸਿਰਫ ਲਗਵਾਈ ਦਾ ਕਿਹਾ ਸੀ ਨਾ ਤੁਸੀਂ ਸਾਨੂੰ ਕਹਿ ਦਿੰਦੇ ਬਈ ਤੁਸੀਂ ਸਮਾਨ ਲੇ ਆਓ ਅਸੀਂ ਸਮਾਨ ਤੁਹਾਨੂੰ ਲਿਆ ਦਿੰਦਾ ਤੁਸੀਂ ਆਪ ਹੀ ਤੋਂ ਲੈ ਕੇ ਆਏ ਹੋ ਤੁਸੀਂ ਆਪ ਹੀ ਉਸ ਚੀਜ਼ ਤੋਂ ਕਿਉਂ ਗਿਆ ਤੁਸੀਂ ਤਾਂ ਇਕੱਲੀ ਉਹ ਲੈਣੀ ਸੀ ਨਾ ਲੇਬਰ ਹੀ ਲੈਣੀ ਸੀ ਲੇਬਰ ਆਪਾਂ ਡੇਢ ਸੋ ਰੁਪਏ ਮਕਾਈ ਸੀ ਤੁਹਾਡੇ ਨਾਲ ਜੀ ਤੇ ਸਰ ਪਤਾ ਕੀ ਚੈੱਕਰ ਹੁੰਦਾ ਚਲੋ ਤੁਸੀਂ ਡੇਡ ਸੋ ਰੁਪਏ ਲੈ ਰਿਹਾ ਕੋਈ ਚੱਕਰ ਨਹੀਂ ਹੁੰਦਾ ਦੋ ਤਿੰਨ ਤੁਹਾਡੇ ਤੋਂ ਕੰਮ ਵੀ ਅਸੀਂ ਕਰਵਾਏ ਤੇ ਕਈ ਵਾਰੀ ਕੀ ਹੁੰਦਾ ਕੋਈ ਛੋਟਾ ਮੋਟਾ ਖਾਂਦਾ ਬੰਦਾ ਐਵੇਂ ਕਰ ਦਿੰਦਾ ਹੁੰਦਾ ਹੁਣ ਸਾਡੇ ਉਪਰ ਟੈਂਕੀ 'ਚ ਹਵਾ ਭਰ ਗਈ ਸੀ ਉਸ ਤੁਸੀਂ ਮਾਮਾ ਨੇ ਦੋ ਤਿੰਨ ਵਾਰ ਕਿਹਾ ਹੋ ਤੁਸੀਂ ਕਰ ਕੇ ਆਏ ਜੇ ਹੁਣ ਤੁਸੀਂ ਪੈਸੇ ਵੀ ਵੱਧ ਲੈ ਰਹੇ ਹੋ ਉਤੋਂ ਤੁਸੀਂ ਉਹ ਚੀਜ ਵੀ ਨਹੀ ਕਰ ਕੇ ਆਏ ਫਿਰ ਤਾਂ ਮਾੜੀ ਗੱਲ ਹੈ ਨਾ ਜੀ ਨਹੀਂ ਬਟ ਫਿਰ ਨਹੀਂ ਨਹੀਂ ਬੁਲਾਈ ਦਾ ਨਹੀਂ ਹੁਣ ਹਾਂ ਪਲੰਬਰ ਸਾਡੇ ਫੈਮਲੀ ਪਲੰਬਰ ਤੁਸੀਂ ਹੋ ਤੇ ਤੁਹਾਨੂੰ ਵੀ ਬੁਲਾਈ ਦੇ ਨਾ ਅਸੀਂ ਕਿਹੜਾ ਕਿਸੇ ਨੂੰ ਆ ਤੇ ਫਿਰ ਮੈਂ ਤਾਂ ਜੀ ਕਿਸੇ ਹੋਰ ਨੂੰ ਕਿਹਾ ਹੀ ਨਹੀਂ ਨਾ ਮੈਂ ਨਹੀ ਗੱਲ ਹੁੰਦੀ ਆ ਬਈ ਜਿਹੜੀ ਚੀਜ਼ ਡੇਡ ਸੋ ਦੀ ਨਾ ਤੁਸੀਂ ਮੈਨੂੰ ਫੋਨ ਕਰੇ ਕਹਿੰਦੇ ਤੁਸੀਂ ਆਪ ਦੇ ਬਿਹਾਫ ਤੇ ਲੇ ਆਏ ਉਸ ਤੋਂ ਬਾਅਦ ਲੇਬਰ ਵਧਾ ਤੀ ਉਹ ਤਾਂ ਗੱਲ ਮਾੜੀ ਹੈ ਨਾ ਜੀ ਤੁਸੀਂ ਮੈਨੂੰ ਕਹਿੰਦੇ ਮੈਂ ਤੁਸੀਂ ਮੈਨੂੰ ਦੋ ਸੋ ਦਾ ਮੈਸੇਜ ਪਾਇਆ ਸੀਗਾ ਵੀ ਦੋ ਸੋ ਕਰ ਦੋ ਮੈਂ ਉਦੋਂ ਡੇਡ ਸੋ ਦਾ ਤੁਹਾਨੂੰ ਕਿਹਾ ਸੀਗਾ ਹੁਣ ਤੁਸੀਂ ਵਿੱਚੋਂ ਪੰਜਾਹ ਰੁਪਏ ਦਾ ਸਮਾਨ ਲਿਆ ਕੁਛ ਵੀ ਲਿਆਏ ਉਹ ਤੁਹਾਡੀ ਗਲਤੀ ਨਾ ਸਾਡੀ ਤਾਂ ਨਹੀਂ ਗਲਤੀ ਨਾ ਲਿਬਰੀ ਆ ਤੁਸੀਂ ਮੈਨੂੰ ਫੋਨ ਕਰਦੇ ਵੀ ਹਾਂ ਯਾਰ ਆਪਣੇ ਆਪ ਦੇ ਤੁਹਾਡੇ ਆ ਤੁਸੀਂ ਗੱਲ ਕੀਤੀ ਸਿੱਧਾ ਮੈਨੂੰ ਕਰਤਾ ਪਤਾ ਨਹੀਂ ਤੁਸੀਂ ਪੰਜਾਹ ਦਾ ਲੈ ਕੇ ਚਲੋ ਸਾਡੇ ਤੁਸੀਂ ਪਲੰਬਰ ਇਹ ਕੋਈ ਦਿੱਕਤ ਨਹੀਂ ਤੁਸੀਂ ਬਟ ਉਹ ਇੱਕ ਡਾਊਟ ਤਾਂ ਰਹਿ ਗਿਆ ਸਾਡੇ ਦਿਮਾਗ ਦੇ ਵਿੱਚ ਬਈ ਹਾਂ ਯਾਰ ਉਹ ਬੰਦੇ ਨੇ ਪੰਜਾਹ ਦਾ ਲਿਤਾ ਸਮਾਨ ਜਿਹੜਾ ਤੁਸੀਂ ਕੀ ਲੈ ਕੇ ਆਏ ਹੋ ਪਤਾ ਨਹੀਂ ਉਹ ਪੱਚੀ ਰੁਪਏ ਦੀ ਚੀਜ ਹੋ ਪੱਚੀ ਰੁਪਏ ਤੁਸੀਂ ਜਿਆਦਾ ਲੈ ਲਿਆ ਹੋਣ ਉਹ ਫਿਰ ਉਹ ਡਾਊਟ ਰਹਿਣ ਦੀ ਮੈਨੂੰ ਫੋਨ ਕਰ ਦਿੰਦੇ ਚਲ ਆਪਾਂ ਉਸੇ ਟਾਈਮ ਕਰ ਲੈਂਦੇ ਵੀ ਮੈਂ ਆ ਕੇ ਆਪ ਲਿਆਦਾ ਗੱਲ ਉਹ ਕੋਠੀ ਦੀ ਗੱਲ ਨਹੀਂ ਹੁੰਦੀ ਉਹਦੀ ਤੁਹਾਨੂੰ ਰੈਗੂਲਰ ਤੁਹਾਡੇ ਕੋਲ ਕੰਮ ਕਰਾਈਦਾ ਕੋਈ ਚਲੋ ਤੁਸੀਂ ਪੈਸੇ ਵੀ ਲੈ ਲੈਣਾ ਤਾਂ ਉਹ ਵੀ ਨਹੀਂ ਕਹੀ ਜਾਂਦਾ ਕੋਈ ਇੱਕ ਮਾੜਾ ਮੋਟਾ ਜਿਹੜਾ ਕੋਈ ਪੇਚ ਕੁ ਕਸਾਂ ਦੇ ਹੁੰਦੇ ਸਾਡੇ ਕੋਲੇ ਕੋਈ ਭੈਣ ਨਹੀਂ ਹੈਗੇ ਮੈਂ ਸਮਾਨ ਵੇਖਿਆ ਉਹਦੇ ਚੋਂ ਵੀ ਜਿਹੜੀ ਇੱਕ ਟੂਟੀ ਕੱਸ ਕੇ ਗਏ ਹੋ ਨਾ ਉਹਦੇ ਉਹਦੇ ਤੇ ਹੀ ਭਾਜੀ ਉਹਦੇ 'ਚ ਵੀ ਇੱਕ ਟੂਟੀ ਅਜੇ ਕੱਲ ਹੀ ਪਰਸੋਂ ਲੀ ਕੱਲ ਲੀਕ ਕਰਨ ਲੱਗ ਗਏ ਮੈਂ ਕਿਹਾ ਨਾਲ ਨਾਲ ਸਾਨੂੰ ਫੋਨ ਕੀਤਾ ਤੇ ਅੰਕਲ ਨੇ ਕਹਿਣਾ ਵੀ ਯਾਰ ਇਹ ਤਾਂ ਫਿਰ ਤੁਸੀਂ ਨਾਲ ਨਾਲ ਫੋਨ ਕਰਤਾ ਉਹਦੇ ਚ ਲੀਕ ਕਰੀ ਜਾਂਦੀ ਹੈ ਤੁਸੀਂ ਪਤਾ ਨਹੀਂ ਕਿਹੜੇ ਸਮਾਨ ਲੈ ਕੇ ਆਏ ਹੋ ਮੈਨੂੰ ਨਹੀਂ ਪਤਾ ਬਟ ਗੱਲ ਇਹ ਹੈ ਪ੍ਰਾਈਜ ਦੀ ਗੱਲ ਹੁੰਦੀ ਆ ਪ੍ਰਾਈਜ ਤੁਸੀਂ ਜਿਹੜੀ ਚੀਜ਼ ਮੁਕਾਈ ਹੈ ਡੇਡ ਸੋ ਮੰਗਾਏ ਤੇ ਡੇਡ ਸੋ ਕਰੋ ਤੁਸੀਂ ਦੋ ਸੋ ਗੱਲ ਤੋਂ ਹੀ ਹੋ ਗਈ ਨਾ ਯਹਾਂ ਤੇ ਤੁਸੀਂ ਬੰਦੇ ਨੂੰ ਪਹਿਲਾਂ ਕਹੋ ਖੇਤੀ ਕਰੀ ਜਾਂਦੀ ਹੈ ਮਮਾ ਹੋਵੇ ਕਹਿ ਰਹੇ ਸੀਗੇ ਮੈਂ ਵੀ ਵੇਖਿਆ ਉਹ ਨਾ ਟਾਈਟ ਜੀ ਹੈਗੀ ਹੈ ਮਤਲਬ ਟਾਈਟ ਜਿਹੀ ਲੱਗ ਰਹੀ ਹੈ ਉਹ ਐ ਤੇ ਐ ਤੇ ਨਹੀਂ ਐ ਤੇ ਟਾਈਮ ਦਾ ਬੰਦਾ ਚੈੱਕ ਕਰਾ ਲੈਦਾ ਬਾਅਦ ਦੇ ਵਿੱਚ ਕਈ ਵਾਰੀ ਕੋਈ ਨੱਟ ਨੂੰ ਢਿਲਾ ਰਹਿ ਜਾਂਦਾ ਕੁਛ ਵੀ ਹੋ ਜਾਂਦਾ ਬੰਦਾ ਨਹੀਂ ਰਹਿੰਦਾ ਤੁਸੀਂ ਪਹਿਲਾਂ ਵੀ ਪਹਿਲਾਂ ਵੀ ਕਈ ਡੇਢ ਤੋਂ ਕਿਹਾ ਵੀ ਤੁਸੀਂ ਦੋ ਸੋ ਲੈ ਕੇ ਆ ਤੁਸੀਂ ਪੰਜਾਹ ਦਾ ਐਵੇਂ ਕਿਹਾ ਹਾਂ ਤੁਸੀਂ ਕਰਕੇ ਜਾਓ ਬਟ ਤੁਸੀਂ ਨਾ ਤੁਹਾਨੂੰ ਹਮੇਸ਼ਾ ਬੁਲਾਈਦਾ ਤੁਸੀਂ ਰੇਟ ਦਾ ਥੋੜਾ ਤੁਸੀਂ ਰੇਟ ਦਾ ਖਿਆਲ ਰੱਖਿਆ ਕਰੋ ਤੁਹਾਡੇ ਤੋਂ ਹਮੇਸ਼ਾ ਕੰਮ ਕਰਾਈਦਾ ਐ ਨਾ ਕਰਿਆ ਕਰੋ ਬਈ ਹਾਂ ਤੁਸੀਂ ਹਮੇਸ਼ਾ ਨਹੀਂ ਉਹ ਤਾਂ ਠੀਕ ਹੈ ਹਾਂ ਹਾਂ ਉਹ ਤੁਸੀਂ ਮਾੜਾ ਨਾ ਕਰ ਲਿਆ ਕਰੋ

ਹਾਂ ਤੇ ਇੱਕੋ ਨਾ ਟੂਟੀ ਦਾ ਵੀ ਮਾੜਾ ਆ ਕਵੇ ਇੱਕ ਰਹਿ ਜਾਓ ਸਹੀ ਹਵਾ ਭਰਦੀ ਸਾਰੀ ਟੈਂਕੀ ਦੇ ਵਿੱਚ ਉਹ ਇਹ ਵੀ ਹਾਂ ਮਤਲਬ ਕੀ ਉਹ ਹੀ ਹੁੰਦਾ ਨਾ ਚਲੋ ਆਪਾਂ ਫੈਮਲੀ ਪਲੰਬਰ ਨੂੰ ਲਾਣਾ ਜਿਹੜਾ ਮੇਨ ਕੰਮ ਉਹ ਤਾਂ ਕਰਾਣਾ ਹੀ ਕਰਾਣਾ ਹੁੰਦਾ ਚਲੋ ਕੋਈ ਜੋ ਛੋਟੇ ਮੋਟੇ ਦੋ ਚਾਰ ਕੰਮ ਹੁੰਦੇ ਉਹ ਤਾਂ ਬੰਦਾ ਚੱਲ ਬੈਠੀ ਧੋਤੀ ਕਰ ਜਾਂਦਾ ਚੱਲ ਯਾਰ ਭਰਾ ਹੈਗੇ ਆ ਨਹੀਂ ਨਾ ਤਾਂ ਨੀ ਕੀਤੀ ਕਦੇ ਹਾ ਵੀ ਨਹੀ ਕੀਤੀ ਚਕਰ ਤਾਂ ਇਹ ਹੀ ਹੈ ਨਹੀ ਨਹੀ ਗੱਲ ਤਾਂ ਹੋਈ ਹੈ ਨਾ ਤੁਸੀਂ ਫਿਰ ਉਹੀ ਗੱਲ ਹੈ ਨਾ ਤੁਸੀਂ ਮੈਂ ਤਾਂ ਹੀ ਕਹਿ ਰਿਹਾ ਤੁਸੀਂ ਆਪਦਾ ਹਾਂ ਹਾਂ ਬਸ ਤੁਸੀਂ ਉਹ ਟੈਂਕੀ ਦਾ ਕਸ ਦਿਆ ਜੇ ਮਾੜਾ ਜਿਹਾ ਚਲੋ ਠੀਕ ਹੈ ਜੀ ਓਕੇ